ਮੈਂ ਜ਼ਿਆਦਾਤਰ ਖ਼ਬਰਾਂ ਜਿਹੜੀਆਂ ਹੈਗੀਆਂ ਨੇ ਮੈਂ ਉਹਦੇ ਵਿੱਚ ਪੰਜਾਬੀ ਭਾਸ਼ਾ ਦੇ ਵਿੱਚ ਦੇਖਦੀ ਹਾਂ ਅਤੇ ਬਹੁਤ ਸਾਰੀਆਂ ਖ਼ਬਰਾਂ ਮੈਂ ਹਿੰਦੀ ਅਤੇ ਇੰਗਲਿਸ਼ ਦੇ ਵਿੱਚ ਵੀ ਦੇਖਦੀ ਹਾਂ ਅਤੇ ਮੇਰੀ ਜਿਹੜੀ ਹੈਗੀ ਆ ਖੇਤਰ ਦੇ ਵਿੱਚ ਕੁਛ ਮੇਰੀ ਜਿਹੜੀ ਸਥਾਨਕ ਭਾਸ਼ਾਵਾਂ ਵਿੱਚ ਕਈ ਤਰ੍ਹਾਂ ਦੀ ਨਿਊਜ਼ ਮੀਡੀਆ ਉਪਲੱਬਧ ਹੈਗੇ ਨੇ ਇੱਥੇ ਜਿਵੇਂ ਅਜੀਤ ਜਗਬਾਣੀ ਉਹਨਾਂ ਦੇ ਖੁਦ ਦੇ ਨਿਊਜ਼ ਪੇਪਰ ਵੀ ਨੇ ਅਤੇ ਉਹਨਾਂ ਦੇ ਯੂਟੀਊਬ ਚੈਨਲਸ ਵੀ ਨੇ ਜਿੱਥੇ ਮੈਂ ਅਗਰ ਮੈਨੂੰ ਲੱਗਦਾ ਕਿ ਕੋਈ ਨਿਊਜ਼ ਮੈਨੂੰ ਕਵਰ ਕਰਨੀ ਚਾਹੀਦੀ ਆ ਜ਼ਰੂਰੀ ਹੈਗੀ ਆ ਤਾਂ ਮੈਂ ਉਹਨਾਂ ਦੇ ਚੈਨਲ ਉੱਤੇ ਜਾਂਦੀ ਆਂ ਅਤੇ ਮੈਂ ਉੱਥੇ ਦੇਖਦੀ ਹਾਂ ਕਿ ਉਹਨਾਂ ਨੇ ਕੀ ਉਹਦੇ ਬਾਰੇ ਦੱਸਿਆ ਹੋਇਆ ਅਤੇ ਮੈਂ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦੀ ਹਾਂ ਅਤੇ ਮੈਂ ਜਿਹੜੀ ਹੈਗੀ ਆ ਆਪਣੀਆਂ ਜ਼ਿਆਦਾਤਰ ਖ਼ਬਰਾਂ ਨੇ ਉਹ ਮੈਂ ਪੰਜਾਬੀ ਭਾਸ਼ਾ ਦੇ ਵਿੱਚ ਹੀ ਦੇਖਦੀ ਹਾਂ ਕਿਉਂਕਿ ਪੰਜਾਬੀ ਭਾਸ਼ਾ ਮੇਰੀ ਜਿਹੜੀ ਮਾਂ ਬੋਲੀ ਹੈ ਅਤੇ ਮੈਂ ਉਹਦੇ ਨਾਲ ਜ਼ਿਆਦਾ ਚੰਗੀ ਤਰ੍ਹਾਂ ਰਿਲੇਟ ਕਰ ਪਾਉਂਦੀ ਹਾਂ ਅਤੇ ਉਹਦੇ ਨਾਲ ਜਿਹੜਾ ਹੈਗਾ ਚੰਗੀ ਤਰ੍ਹਾਂ ਸਮਝ ਵੀ ਆ ਜਾਂਦਾ ਮੈਨੂੰ